ਜੀ ਹਾਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਬੱਚਿਆਂ ਦਾ ਮਨੋਬਲ ਵੱਧਦਾ ਹੈ ਪੰਜਾਬੀ ਭਾਸ਼ਾ ਸਾਡਾ ਵਿਰਸਾ ਹੈ ਜੇਕਰ ਅਸੀਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਹੀ ਨਾ ਸਿਖਾਵਾਂਗੇ ਤਾਂ ਸਾਡਾ ਵਿਰਸਾ ਕੌਣ ਸੰਭਾਲੇਗਾ ਜੋ ਕਿ ਪੰਜਾਬੀ ਭਾਸ਼ਾ ਨੂੰ ਸਮਝਣਾ ਅਤੇ ਪੜ੍ਹਨਾ ਵੀ ਸੌਖਾ ਹੈ ਇਸ ਲਈ ਬੱਚਿਆਂ ਨੂੰ ਪੰਜਾਬੀ ਭਾਸ਼ਾ ਜ਼ਰੂਰ ਆਉਣੀ ਚਾਹੀਦੀ ਹੈ ਜੇਕਰ ਕੋਈ ਵਿਅਕਤੀ ਪੰਜਾਬ ਵਿੱਚ ਰਹਿ ਕੇ ਪੰਜਾਬੀ ਭਾਸ਼ਾ ਹੀ ਨਾ ਪੜ੍ਹ ਸਕਿਆ ਜਿਸ ਤਰ੍ਹਾਂ ਸਾਡੀ ਗੁਰਬਾਣੀ ਵੀ ਇੱਕ ਪੰਜਾਬੀ ਭਾਸ਼ਾ ਵਿੱਚ ਹੈ ਉਸਨੂੰ ਨਾ ਪੜ੍ਹ ਸਕਿਆ ਤਾਂ ਲਾਹਨਤ ਹੈ ਇਸ ਪੰਜਾਬੀ ਉਸ ਨੂੰ ਪੰਜਾਬੀ ਹੋਣ 'ਤੇ ਪੰਜਾਬੀ ਭਾਸ਼ਾ ਸਾਡੀ ਬਹੁਤ ਮਹੱਤਵਪੂਰਨ ਭਾਸ਼ਾ ਹੈ ਜੇਕਰ ਅਸੀਂ ਪੰਜਾਬੀ ਬੋਲਾਂਗੇ ਤਾਂ ਸਾਡੇ ਭਵਿੱਖ ਵਿੱਚ ਜੋ ਕਿ ਸਾਡੇ ਆਉਣ ਵਾਲੇ ਬੱਚੇ ਹਨ ਉਹ ਵੀ ਪੰਜਾਬੀ ਭਾਸ਼ਾ ਪੜ੍ਹਨਗੇ ਸਮਝਣਗੇ ਅਤੇ ਲਿਖਣਗੇ ਪੰਜਾਬੀ ਭਾਸ਼ਾ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਜਿਸ ਜਿਸ ਤਰ੍ਹਾਂ ਸਾਡੇ ਇਤਿਹਾਸਿਕ ਇਤਿਹਾਸ ਵਿੱਚ ਇਤਿਹਾਸਕ ਗ੍ਰੰਥ ਹਨ ਜਿੱਦਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ ਦੇ ਪਾਠ ਹਨ ਉਹ ਸਭ ਪੰਜਾਬੀ ਭਾਸ਼ਾ ਵਿੱਚ ਹੀ ਹਨ ਇਸ ਲਈ ਹਰ ਇੱਕ ਵਿਅਕਤੀ ਨੂੰ ਪੰ ਪੰਜਾਬੀ ਭਾਸ਼ਾ ਆਉਣੀ ਜ਼ਰੂਰੀ ਹੈ ਪੰਜਾਬੀ ਭਾਸ਼ਾ ਜ਼ਰੂਰੀ ਨਹੀਂ ਕਿ ਸਾਡੇ ਲਿਟਰੇਸੀ ਗਿਆਨ ਨੂੰ ਹੀ ਵਾਧਾ ਕਰਦੀ ਹੈ ਇਹ ਜਿੱਦਾਂ ਪੰਜਾਬੀ ਭਾਸ਼ਾ ਆਉਣੀ ਜ਼ਰੂਰੀ ਹੈ ਉਸ ਤਰ੍ਹਾਂ ਉਹ ਪੰਜਾਬ ਦੇ ਹੋਰ ਵੀ ਕਈ ਭਾਸ਼ਾਵਾਂ ਹਨ ਜੋ ਕਿ ਇੱਕ ਵਿਅਕਤੀ ਨੂੰ ਜ਼ਰੂਰ ਆਉਣੀਆਂ ਚਾਹੀਦੀਆਂ ਹਨ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਹਰ ਇੱਕ ਵਿਅਕਤੀ ਲਈ ਜ਼ਰੂਰੀ ਹੈ ਕਿਉਂਕਿ ਇਹ ਮ ਇਹ ਪੰਜਾਬੀ ਭਾਸ਼ਾ ਸਾਡੇ ਜੀਵਨ ਵਿੱਚ ਬਹੁਤ ਯੋਗਦਾਨ ਪਾਉਂਦੀ ਹੈ ਜੇਕਰ ਅਸੀਂ ਪੰਜਾਬੀ ਭਾਸ਼ਾ ਵਿੱਚ ਕੋਈ ਵੀ ਨੋਵਲ ਜਾਂ ਕੋਈ ਵੀ ਕਿਸੇ ਵੀ ਚੀਜ਼ ਕੋਈ ਵੀ ਇਤਿਹਾਸਿਕ ਜਗ੍ਹਾ ਦਾ ਵਰਣਨ ਕਰਦੇ ਹਾਂ ਉਸ ਵਿੱਚ ਪੰਜਾਬੀ ਭਾਸ਼ਾ ਸ਼ਾਮਿਲ ਹੋਣੀ ਜ਼ਰੂਰੀ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਕਰਕੇ ਅਸੀਂ ਕੋਈ ਕਿਸੇ ਵੀ ਪ੍ਰਕਾਰ ਦਾ ਇਤਿਹਾਸ ਜਾਂ ਕਿਸੇ ਵੀ ਜਗ੍ਹਾ ਦਾ ਵਰਣਨ ਕਰ ਸਕਦੇ ਹਾਂ ਕੋਈ ਵੀ ਸ ਕਹਾਣੀ ਲਿਖ ਸਕਦੇ ਹਾਂ ਪੰਜਾਬੀ ਭਾਸ਼ਾ ਦਾ ਜ਼ਿਕਰ ਹਰ ਇੱਕ ਵਿਅਕਤੀ ਕੋਲੋਂ ਸੁਣਿਆ ਜਾ ਸਕਦਾ ਹੈ ਜੋ ਕਿ ਪੰਜਾਬ ਵਿੱਚ ਰਹਿੰਦਾ ਹੈ ਜੇਕਰ ਪੰਜਾਬੀ ਵਿੱਚ ਰਹਿਣ ਦੇ ਬਾਵਜੂਦ ਕਿਸੇ ਵਿਅਕਤੀ ਨੂੰ ਪੰਜਾਬੀ ਭਾਸ਼ਾ ਨੂੰ ਦਾ ਗਿਆਨ ਨਾ ਹੋਇਆ ਤਾਂ ਉਸ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਉਹ ਪੰਜਾਬੀ ਭਾਸ਼ਾ ਨੂੰ ਚੰਗੇ ਤਰੀਕੇ ਨਾਲ ਸਿੱਖੇ ਕਿਉਂਕਿ ਸਾਡੇ ਗੁਰੂਆਂ ਦੀ ਭਾਸ਼ਾ ਵੀ ਪੰਜਾਬੀ ਹੀ ਸੀ ਇਸ ਲਈ ਸਾਨੂੰ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ ਪੰਜਾਬੀ ਭਾਸ਼ਾ ਸਾਡੇ ਆਉਣ ਵਾਲੇ ਭਵਿੱਖ ਵਿੱਚ ਘੱਟਦੀ ਜਾ ਰਹੀ ਹੈ ਇਸ ਲਈ ਸਾਨੂੰ ਪੰਜਾਬੀ ਭਾਸ਼ਾ ਦੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ